ਮੈਂ ਬੁਣਾਈ ਦਾ ਪ੍ਰਯੋਗ ਸਿਰਫ ਆਪਣੇ ਆਪਣੇ ਘਰ ਘਰ ਪਰਿਵਾਰ ਦੇ ਮੈਂਬਰਾਂ ਲਈ ਹੀ ਕਰਦੀ ਹਾਂ ਇਹ ਮੇਰਾ ਸ਼ੌਂਕ ਹੈ ਬਾਕੀ ਜ਼ਿੰਮੇਵਾਰੀਆਂ ਅਤੇ ਇਸ ਰੁਚੀ ਨੂੰ ਵਿੱਚ ਮੈਂ ਬਹੁਤ ਸੰਤੁਲਿਤ ਸੰਤੁਲਨ ਬਣਾਇਆ ਹੋਇਆ ਹੈ ਮੈਂ ਹਰੇਕ ਕੰਮ ਇੱਕ ਟਾਈਮ ਟੇਬਲ ਦੇ ਹਿਸਾਬ ਨਾਲ ਕਰਦੀ ਹਾਂ ਜਿਸ ਵਿੱਚ ਮੈਂ ਆਪਣੇ ਆਪਣੀਆਂ ਰੂਚੀਆਂ ਨੂੰ ਵੀ ਐਡ ਕੀਤਾ ਹੋਇਆ ਹੈ ਕਿਉਂਕਿ ਇਹ ਮੈਨੂੰ ਖੁਸ਼ੀ ਪ੍ਰਦਾਨ ਕਰਦੇ ਹੈ ਬੁਣਨ ਲਈ ਮੈਂ ਅਤੇ ਸਿਲਾਈ ਕਰਨ ਲਈ ਸਮਾਂ ਮੈਂ ਆਪਣੇ ਟਾਈਮ ਟੇਬਲ ਦੇ ਹਿਸਾਬ ਨਾਲ ਹੀ ਕੱਢਦੀ ਹਾਂ ਮੈਨੂੰ ਪ੍ਰੇਰਿਤ ਰਹਿਣ ਲਈ ਮੈਂ ਯੂਟਿਊਬ ਅਤੇ ਇੰਸਟਾਗ੍ਰਾਮ 'ਤੇ ਪੇਜ਼ ਫੋਲੋ ਕੀਤੇ ਹੋਏ ਹਨ ਜੋ ਕਿ ਸਮੇਂ ਦੇ ਹਿਸਾਬ ਨਾਲ ਤਕਨੀਕਾਂ ਅਤੇ ਪ੍ਰੋਜੈਕਟਾਂ ਬਾਰੇ ਦੱਸਦੇ ਰਹਿੰਦੇ ਹਨ ਅਤੇ ਮੈਂ ਅੱਪਡੇਟ ਰਹਿੰਦੀ ਹਾਂ